ਬੈਂਕ ਦੀ ਨੌਕਰੀ ਲੈਣ ਲਈ ਪਹਿਲੇ ਆਪਣੇ ਕੋਲ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਅਕਾਊਂਟ ਪਲਸ ਅਕਾਊਂਟ ਆਣਾ ਚਾਹੀਦਾ ਵੈ ਮੈਥ ਵਧੀਆ ਹੋਣਾ ਚਾਹੀਦਾ ਵੈ ਪਲਸ ਟੂ ਜਿਹੜੀ ਆਪਾਂ ਉਹ ਕਮਰਸ ਵਿੱਚ ਹੋਣੀ ਚਾਹੀਦੀ ਹੈ ਰਜਿਊਮ ਬਹੁਤ ਅੱਛਾ ਬਣਿਆ ਹੋਣਾ ਚਾਹੀਦਾ ਵੈ ਪਲੱਸ ਪੇਪਰ ਭਰਦੇ ਰਹਿਣੇ ਚਾਹੀਦੇ ਆ ਫਿਰ ਵੀ ਟੈਸਟ ਦੇਣੇ ਪੈਂਦੇ ਆ ਫਿਰ ਆਪਣੀ ਅਗਰ ਟੈਸਟ ਵਿੱਚ ਸਲੈਕਸ਼ਨ ਹੋ ਜਾਂਦੀ ਹ ਫਿਰ ਇੰਟਰਵਿਊ ਹੁੰਦੀ ਹੈ ਉਤੋਂ ਬਾਅਦ ਬੈਂਕ 'ਚ ਕੰਮ ਕਰਨ ਨਾਲ ਐਕਸਪੀਰੀਅੰਸ ਬਹੁਤ ਮਿਲਦਾ ਵੈ ਕਾਫੀ ਐਕਸਪੀਰੀਅੰਸ ਮਿਲਦਾ ਵੈ ਬਾਕੀ ਬਹੁਤ ਸਾਲ ਬਾਅਦ ਇੰਕਰੀਜ ਲੱਗਦੀ ਹੈ ਸੈਲਰੀਜ਼ ਵਿੱਚ ਲੀਵ ਵੀ ਮਿਲਦੀ ਹੈ ਮੈਟਰਨੀਟੀ ਮਿਲਦੀ ਹੈ ਛੇ ਮਹੀਨਿਆਂ ਦੀ ਫਰੀ ਸੈਲਰੀ ਵੀ ਮਿਲਦੀ ਹੈ

ਲੋਨ 'ਤੇ ਇੰਟਰਸਟ ਵੀ ਅੱਛਾ ਘੱਟ ਪੈਂਦਾ ਵੈ ਈਜ਼ਲੀ ਲੋਨ ਮਿਲ ਜਾਂਦਾ ਵੈ ਧੰਨਵਾਦ